ਨਹੀਂ ਮੈਂ ਕਦੇ ਵੀ ਪੰਜਾਬੀ ਦੇ ਖੇਤਰ ਵਿੱਚ ਕੋਈ ਉਪਭਾਸ਼ਾ ਨਹੀਂ ਸਿੱਖੀ ਨਾ ਹੀ ਆਪਣੇ ਜ਼ਿੰਦਗੀ ਦੇ ਵਿੱਚ ਵਰਤਦੀ ਹਾਂ ਪਰ ਜੋ ਮੈਂ ਬੋਲਦੀ ਹਾਂ ਮੈਨੂੰ ਇਦਾਂ ਲੱਗਦਾ ਹੈ ਕਿ ਇਹ ਹੀ ਪੰਜਾਬੀ ਭਾਸ਼ਾ ਹੈ ਪੰਜਾਬੀ ਭਾਸ਼ਾ ਆਪੋ ਹੀ ਆਪ ਦੇ ਵਿੱਚ ਇੱਕ ਪਿਆਰੀ ਭਾਸ਼ਾ ਹੈ ਪਿਆਰ ਦਾ ਬੋਲ ਹੈ ਪੰਜਾਬੀ ਪੰਜ ਦਰਿਆ ਦਾ ਦਰਿਆਵਾਂ ਦਾ ਸਮੂਹ ਪੰਜਾਬੀ ਪੰਜਾਬੀ ਭਾਸ਼ਾ ਉਹਦੇ ਵਰਣਮਾਲਾ ਅਤੇ ਉਹਦੇ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਮੈਨੂੰ ਸਿੱਖਣ ਦੇ ਵਿੱਚ ਕਾਫੀ ਰੁਚੀ ਹੈ ਪਰ ਮੈਂ ਆਪਣੇ ਹਿੱਤ ਦੇ ਲਈ ਸੋਚਦੀ ਹਾਂ ਕਿ ਮੈਨੂੰ ਅੱਗੇ ਚੱਲ ਕੇ ਹੋਰ ਇਹਦਾ ਇਹਨਾਂ ਦੇ ਉਪ ਭਾਸ਼ਾਵਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਰਤਣਾ ਚਾਹੀਦਾ ਹੈ ਅਤੇ ਪੰਜਾਬੀ ਦੇ ਮੈਨੂੰ ਮਾਝੀ ਅਤੇ ਠੇਠ ਪੰਜਾਬੀ ਜਿਹੜੀ ਹੁੰਦੀ ਹੈ ਮੈਨੂੰ ਉਹ ਕਾਫੀ ਹੱਦ ਤੱਕ ਚੰਗੀ ਲੱਗਦੀ ਹੈ ਸੁਣਨ ਦੇ ਵਿੱਚ ਵੀ ਬੋਲਣ ਦੇ ਵਿੱਚ ਵੀ ਔਰ ਹੋ ਸਕਦਾ ਹੈ ਕਿ ਮੈਂ ਕਿਤੇ ਨਾ ਕਿਤੇ ਅੱਗੇ ਚੱਲ ਕੇ ਉਹ ਸਿੱਖਾਂ ਅਤੇ ਚੰਗੀ ਤਰ੍ਹਾਂ ਨਾਲ ਸਿੱਖਾਂ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਸਮੇਂ ਕੁ ਸਮੇਂ ਮੈਂ ਉਹ ਉਹ ਲੋਕਾਂ ਦੇ ਲਈ ਲੋਕਾਂ ਦੇ ਨਾਲ ਉਹ ਭਾਸ਼ਾ ਦੇ ਵਿੱਚ ਗੱਲ ਕਰਾਂ ਅਤੇ ਉਹਨਾ ਉਹ ਉਹ ਲੋਕ ਜੋ ਬੋਲਦੇ ਹਾਂ ਪੰਜਾਬੀ ਪੰਜਾਬੀ ਭਾਸ਼ਾ ਉਹਨਾਂ ਦੇ ਵਿੱਚ ਰਸਾਂ ਵਸਾਂ ਅਤੇ ਮੈਨੂੰ ਇਦਾਂ ਦਾ ਲੱਗਦਾ ਹੈ ਕਿ ਪੰਜਾਬੀ ਪੰਜਾਬੀ ਭਾਸ਼ਾ ਨਹੀਂ ਹੈ ਪੰਜਾਬੀ ਇੱਕ ਪਿਆਰੀ ਲੈਂਗੁਏਜ ਹੈ ਪਿਆਰੀ ਭਾਸ਼ਾ ਹੈ ਜੋ ਕਿ ਹਰ ਕਿਸੇ ਨੂੰ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਹਰ ਪੰਜਾਬੀ ਨੂੰ ਬੋਲਣ ਦੇ ਵਿੱਚ ਅਤੇ ਸੁਣਨ ਦੇ ਵਿੱਚ ਬਹੁਤ ਚੰਗਾ ਲੱਗਦਾ ਹੈ ਅਤੇ ਫ਼ਕਰ ਮਹਿਸੂਸ ਹੁੰਦਾ ਹੈ ਕਿ ਅਸੀਂ ਪੰਜਾਬ ਦੇ ਵਾਸੀ ਹਾਂ